ਮੈਨੂੰ ਟ੍ਰੈਡਮਿਲ 'ਤੇ ਦੌੜਨੇ ਅਤੇ ਜ਼ਮੀਨ 'ਤੇ ਜ਼ਿਆਦਾ ਦੌੜਨਾ ਪਸੰਦ ਹੈ ਜੋ ਕਿ ਮਿੱਟੀ ਦੇ ਵਿੱਚ ਕਾਫ਼ੀ ਜ਼ਿਆਦਾ ਵਧੀਆ ਲੱਗ ਰਿਹਾ ਅ ਜ਼ਮੀਨ ਦੇ ਉੱਪਰ ਦੌੜਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਏ ਜੋ ਕਿ ਪੈਰਾਂ ਨੂੰ ਰੋੜੀਆਂ ਲੱਗਦੀਆਂ ਕੁਝ ਹੋਰ ਲੱਗਦਾ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪੈਰ ਪੱਕਦੇ ਹੈ ਤਾਂ ਬਹੁਤ ਜ਼ਿਆਦਾ ਵਧੀਆ ਸਾਂਹ ਬਣਦਾ